ਹਾਂ ਸਾਡੇ ਖੇਤਰ ਦੇ ਵਿੱਚ ਵੈਟਨਰੀ ਡਾਕਟਰ ਹਨ ਸਾਡੇ ਰੋਪੜ ਜ਼ਿਲ੍ਹੇ ਦੇ ਵਿੱਚ ਰਾਮਲੀਲਾ ਗਰਾਊਂਡ ਹੈ ਬੇਲਾ ਚੌਂਕ ਦੇ ਕੋਲ ਉਸ ਦੇ ਕੋਲ ਹੀ ਰੋਪੜ ਜ਼ਿਲ੍ਹੇ ਦਾ ਸਰਕਾਰੀ ਵੈਟਨਰੀ ਹਸਪਤਾਲ ਬਣਿਆ ਵਾ ਹੈ ਹੁਣ ਉਸ ਜਗ੍ਹਾ 'ਤੇ ਅਸੀਂ ਆਪਣੇ ਜਾਨਵਰਾਂ ਨੂੰ ਅਲੱਗ ਅਲੱਗ ਤਰ੍ਹਾਂ ਦੇ ਵੈਕਸੀਨਾਂ ਲਗਵਾ ਸਕਦੇ ਹਾਂ ਅਤੇ ਸਰਕਾਰ ਦੁਆਰਾ ਸਾਨੂੰ ਸਾਡੇ ਜਾਨਵਰਾਂ ਦੇ ਲਈ ਕੀੜਿਆਂ ਦੀਆਂ ਦਵਾਈਆਂ ਅਤੇ ਵੈਕਸੀਨਾਂ ਇੱਕ ਲੋੜੀਂਦੇ ਸਮੇਂ ਤੋਂ ਬਾਅਦ ਉਪਲਬਧ ਕਰਵਾਈਆਂ ਜਾਂਦੀਆਂ ਹਨ ਅਤੇ ਸਾਡੇ ਉਰੇ ਜੋ ਕਿ ਸਰਕਾਰੀ ਹੈ ਉਸ ਦੇ ਵਿੱਚ ਬਹੁਤ ਸਸਤੇ ਅਤੇ ਕਹਿ ਲੋ ਕਿ ਘੱਟ ਪੈਸਿਆਂ ਦੇ ਵਿੱਚ ਜਾਨਵਰਾਂ ਦਾ ਇਲਾਜ ਹੋ ਜਾਂਦਾ ਹੈ ਬਟ ਰੋਪੜ ਦੇ ਵਿੱਚ ਕੁਝ ਪ੍ਰਾਈਵੇਟ ਦੁਕਾਨਾਂ ਵੀ ਹਨ ਜੋ ਜਾਨਵਰਾਂ ਦੇ ਇਲਾਜ ਕਰਦੀਆਂ ਹਨ ਪਰ ਉੱਥੇ ਸਾ ਲੋਕਾਂ ਦੇ ਲਈ ਉਹ ਥੋੜ੍ਹੇ ਮਹਿੰਗੇ ਸਾਬਿਤ ਹੁੰਦੇ ਹਨ